ਸਤਿ ਸ਼੍ਰੀ ਅਕਾਲ ਜੀ ਕੁਛ ਸਥਾਨਕ ਸੰਭਾਵਨਾ ਜਾਂ ਵਾਤਾਵਰਨ ਸਬੰਧੀ ਪਹਿਲਕਦਮੀਆਂ ਇਹ ਹਨ ਜੋ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਮਹੱਤਵਪੂਰਨ ਜਿਵੇਂ ਕਿ ਸਾਨੂੰ ਆਪਣਾ ਵਾਤਾਵਰਨ ਹਮੇਸ਼ਾ ਸਵੱਛ ਰੱਖਣਾ ਚਾਹੀਦਾ ਕਿਉਂਕਿ ਜੇਕਰ ਸਵੱਛ ਵਾਤਾਵਰਨ ਹੋਵੇਗਾ ਤਾਂ ਫਿਰ ਆਪਾਂ ਆਪਣੀ ਜ਼ਿੰਦਗੀ ਨੂੰ ਚੰਗੇ ਤਰੀਕੇ ਨਾਲ ਜੀਅ ਸਕਦੇ ਹਾਂ ਅਤੇ ਦੇਖੋ ਜੀ ਜੇਕਰ ਗੰਦਾ ਵਾਤਾਵਰਨ ਹੋਵੇਗਾ ਤਾਂ ਸਾਡਾ ਵੀ ਰਹਿਣ ਦਾ ਮਨ ਨਹੀਂ ਕਰੇਗਾ ਬਿਮਾਰੀਆਂ ਫੈਲਣਗੀਆਂ ਲੱਖਾਂ ਰੁਪਏ ਲੱਗਣਗੇ ਇਲਾਜ ਵਿੱਚ ਉਹ ਇਲਾਜ ਦੇ ਲਾਉਣ ਤੋਂ ਚੰਗਾ ਸਾਨੂੰ ਵਾਤਾਵਰਨ ਸ਼ੁੱਧ ਰੱਖਣਾ ਚਾਹੀਦਾ ਹੈ ਸਾਨੂੰ ਜੋ ਵੀ ਵਾਤਾਵਰਨ 'ਚ ਨੁਕਸਾਨਦਾਇਕ ਵਸਤੂਆਂ ਨੇ ਉਨ੍ਹਾਂ ਨੂੰ ਨਹੀਂ ਵਰਤੋਂ ਵਿੱਚ ਕਰਨਾ ਚਾਹੀਦਾ ਇਹਨਾਂ ਪਹਿਲ ਕਦਮੀਆਂ ਨੂੰ ਕਾਫੀ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਜਿਵੇਂ ਕਈ ਸਾਰੇ ਲੋਕਾਂ ਨੇ ਇਹਨਾਂ ਚੀਜ਼ਾਂ ਨੂੰ ਕਰਦੇ ਨੇ ਕਈ ਲੋਕ ਆਪਣਾ ਸੋਚ ਨਿਕਲ ਜਾਂਦੇ ਨੇ ਕਿ ਸਾਡਾ ਕੀ ਸਾਨੂੰ ਕੀ ਸਾਡਾ ਤਾਂ ਸਫਲਤਾ ਇਹ ਇਹੀ ਹੈ ਕਿ ਕਿ ਉਹ ਜੇਕਰ ਆਪਣਾ ਵਧੀਆ ਰੱਖਣਗੇ ਅੱਗੇ ਜਾ ਕੇ ਕੋਈ ਦਿੱਕਤ ਨਹੀਂ ਆਵੇਗੀ ਜਿਹੜੀ ਇਹ ਜਿਹੜੀਆਂ ਪਹਿਲੀਆਂ ਕਦਮੀਆਂ ਹਾਂ ਕਰਦੇ ਹਾਂ ਇਹ ਵਾਤਾਵਰਨ ਨੂੰ ਸ਼ੁੱਧ ਅਤੇ ਵਧੀਆ ਰੱਖਦੇ ਵਾਤਾਵਰਨ ਬਹੁਤ ਵਧੀਆ ਲੱਗਦੇ ਆਪਾਂ ਜੇਕਰ ਆਪਣਾ ਵਾਤਾਵਰਨ ਨੂੰ ਸ਼ੁੱਧ ਰੱਖਾਂਗੇ ਤਾਂ ਵਧੀਆ ਹੀ ਰਹੇਗਾ ਇਹ ਇੱਕ ਵਧੀਆ ਚੀਜ਼ ਹੁੰਦੀ ਚਲੋ ਹਰਿਆਲੀ ਰਹਿੰਦੀ ਇਹ ਮੰਨੇ ਕੋਈ ਗੰਦਗੀ ਨਹੀਂ ਰਹਿੰਦੀ ਕੋਈ ਪਾਣੀ ਜਿਹੜਾ ਇਕੱਠਾ ਹੋਵੇ ਉਨ੍ਹਾਂ ਦੇਖ ਕੇ ਪਾਣੀ ਨੂੰ ਸਾਫ ਕਰ ਦੇਣਾ ਚਾਹੀਦਾ ਜਾਂ ਕਿ ਗੰਦੇ ਮੱਛਰ ਨਾ ਆਉਣ ਅਤੇ ਬਿਮਾਰੀਆਂ ਨਾ ਫੈਲਣ ਧੰਨਵਾਦ